ਅੱਜ ਕੱਲ੍ਹ ਪੰਜਾਬ ਦੇ ਵਿੱਚ ਮੇਨਲੀ ਦੋ ਵੈਦਰ ਹੁੰਦੇ ਆ ਸਰਦੀਆਂ ਦਾ ਅਤੇ ਗਰਮੀਆਂ ਦਾ ਗਰਮੀਆਂ ਦਾ ਵੈਦਰ ਮੈਨੂੰ ਵਧੀਆ ਨਹੀਂ ਲੱਗਦਾ ਇਸ ਕਰਕੇ ਮੈਨੂੰ ਸਰਦੀ ਦਾ ਵੈਦਰ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਤਿਉਹਾਰ ਹੁੰਦੇ ਆ ਇੱਥੇ ਬਹੁਤ ਜ਼ਿਆਦਾ ਰੀਜਨ ਆ ਮੈਨੂੰ ਸਰਦੀ ਦਾ ਵੈਦਰ ਕਿਉਂ ਵਧੀਆ ਲੱਗਦਾ ਹੈ ਪਰ ਉਹਦਾ ਪਹਿਲਾ ਰੀਜ਼ਨ ਹੈ ਆਹ ਹੈ ਕਿ ਸਰਦੀਆਂ ਦੇ ਵਿੱਚ ਦਿਨ ਛੋਟੇ ਹੁੰਦੇ ਆ ਅਤੇ ਉਹਦੇ ਕਾਰਨ ਮੈਂ ਆਰਾਮ ਨਾਲ ਆਪਣੇ ਘਰ ਬੈਠ ਕੇ ਆਪਣੇ ਘਰਦਿਆਂ ਦੇ ਨਾਲ ਟਾਈਮ ਗੁਜ਼ਾਰ ਸਕਦਾ ਹੈ ਅਤੇ ਦੂਜਾ ਰੀਜਨ ਐਵੇਂ ਆ ਅਤੇ ਉੱਥੇ ਦਿਨ ਛੋਟੇ ਹੁੰਦੇ ਹੈ ਉਹਦੇ ਕਰਕੇ ਧੁੰਦ ਵੀ ਹੁੰਦੀ ਆ ਅਤੇ ਧੁੰਦ ਦੇ ਨਾਲ ਸਾਰਾ ਏਰੀਆ ਗਿੱਲਾ ਗਿੱਲਾ ਰਹਿੰਦਾ ਉਹਦੇ ਕਾਰਨ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਘੱਟਦਾ ਹੈ ਤੀਜਾ ਰੀਜਨ ਐਵੇਂ ਕਰਕੇ ਆ ਕਿ ਸਰਦੀਆਂ ਦੇ ਵਿੱਚ ਬਹੁਤ ਤਰ੍ਹਾਂ ਦੇ ਅਲੱਗ ਅਲੱਗ ਫੈਸਟੀਵਲ ਆਉਂਦੇ ਆ ਜਿਵੇਂ ਕਿ ਦਿਵਾਲੀ ਅ ਦਿਵਾਲੀ ਦੁਸਹਿਰਾ ਸਿੰਘ ਸਭਾ ਹੋ ਗਈ ਹੋਲੀ ਵਗੈਰਾ ਹੋ ਗਈ ਅਤੇ ਉਹਦੇ ਕਾਰਨ ਮੈਂ ਆਪਣੇ ਘਰਦਿਆਂ ਦੇ ਨਾਲ ਅਰਾਮ ਨਾਲ ਟਾਈਮ ਸਪੈਂਡ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਦੇ ਫੈ ਫੈਸਟੀਵਲ ਦੇ ਵਿੱਚ ਮੈਂ ਬਹੁਤ ਚੀਜ਼ਾਂ ਕਰਦਾ ਹਾਂ ਅੱਜ ਕੱਲ੍ਹ ਲੋਕਾਂ ਕੋਲ ਬਹੁਤ ਘੱਟ ਸਮਾਂ ਹੁੰਦਾ ਹੈ ਆਪਣੇ ਦੋਸਤਾਂ ਨੂੰ ਜਾਂ ਮਿੱਤਰਾਂ ਮਿੱਤਰਾਂ ਨੂੰ ਮਿਲਣ ਨੂੰ ਉਹਦੇ ਕਰਕੇ ਸਰਦੀਆਂ ਦੇ ਵਿੱਚ ਉਹ ਆਰਾਮ ਨਾਲ ਆਪਣੇ ਦੋਸਤਾਂ ਨੂੰ ਮਿਲ ਲੈਂਦੇ ਹੈ ਕਿਉਂਕਿ ਇੱਥੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਤਿਉਹਾਰ ਹੁੰਦੇ ਹੈ ਉਹਦੇ ਕਰਕੇ ਉਹਨਾਂ ਨੂੰ ਕੋਲਜ ਜਾਂ ਸਕੂਲਾਂ ਕਾਲਜਾਂ ਤੋਂ ਆਰਾਮ ਨਾਲ ਛੁੱਟੀਆਂ ਮਿਲ ਜਾਂਦੀਆਂ ਹੈ ਇਹ ਮੇਰਾ ਸਾਰਿਆਂ ਤੋਂ ਮਨਪਸੰਦ ਵੈਦਰ ਆ ਕਿਉਂਕਿ ਇਹਦੇ ਵਿੱਚ ਮੈਂ ਆਪਣਾ ਆਰਾਮ ਨਾਲ ਘਰ ਬੈਠ ਸਕਦਾ ਹੈ ਅਤੇ ਉਹਦੇ ਕਰਕੇ ਮੈਂ ਆਪਣਾ ਆਰਾਮ ਨਾਲ ਰਜਾਈ ਦੇ ਵਿੱਚ ਬੈਠ ਸਕਦਾ ਹੈ ਅਤੇ ਗਰਮ ਕੱਪੜੇ ਪਾ ਸਕਦਾ ਕਿਉਂਕਿ ਵੱਡੇ ਵੱਡੇ ਕੱਪੜੇ ਜੈਕਟਾਂ ਪਾਉਣੀਆਂ ਮੇਰੀ ਹੋਬੀ ਆ ਹੋਬੀ ਆ ਅਤੇ ਉਹਦੇ ਵਿੱਚ ਮੇਰੀ ਪਰਸਨੈਲਿਟੀ ਵੀ ਬਹੁਤ ਜੱਚਦੀ ਆ ਗਰਮੀਆਂ ਦੇ ਵਿੱਚ ਸਿੰਗਲ ਕੱਪੜੇ ਪਾ ਕੇ ਘੁੰਮਣਾ ਪੈਂਦਾ ਹੈ ਅਤੇ ਗਰਮੀਆਂ ਦੇ ਵਿੱਚ ਲੋਕਾਂ ਕੋਲ ਇੰਨਾ ਟਾਇਮ ਨਹੀਂ ਹੁੰਦਾ ਕਿਤੇ ਆਪਣੇ ਦੋਸਤਾਂ ਨੂੰ ਮਿਲਣ ਲਈ ਕਿਉਂਕਿ ਉਹ ਪਹਿਲੀ ਗਰਮੀ ਤੋਂ ਘਬਰਾਏ ਹੁੰਦੇ ਆ ਗਰਮੀਆਂ ਤੋਂ ਘਬਰਾਏ ਹੁੰਦੇ ਆ ਅਤੇ ਉਹ ਗਰਮੀਆਂ ਦੇ ਵਿੱਚ ਏ ਸੀਆਂ ਦਾ ਬਿੱਲ ਵੀ ਬਹੁਤ ਜ਼ਿਆਦਾ ਆਉਂਦਾ ਹੈ ਜੇ ਉਹ ਸਰਦੀਆਂ ਦੇ ਵਿੱਚ ਰਹੂਗੇ ਅਤੇ ਉਹਦੇ ਸਰਦੀਆਂ ਦੇ ਵਿੱਚ ਰਹੂਗੇ ਤਾਂ ਉਹਨਾਂ ਦਾ ਬਿੱਲ ਵੀ ਘਟੂਗਾ ਅਤੇ ਜ਼ ਜ਼ਿਆਦਾਤਰ ਸਰਦੀਆਂ ਦੇ ਵਿੱਚ ਲੋਹੜੀ ਫੈਸਟੀਵਲ ਬਹੁਤ ਜ਼ਿਆਦਾ ਮਨਾਇਆ ਜਾਂਦਾ ਲੋਕਾਂ ਦੁਆਰਾ ਕਿਉਂ ਅਤੇ ਲੋਹੜੀ ਫੈਸਟੀਵਲ 'ਤੇ ਸਰਦੀਆਂ ਦੇ ਵਿੱਚ ਬੂਟਿਆਂ ਦੇ ਨਵੇਂ ਨਵੇਂ ਪੱਤੇ ਵੀ ਆਉਣ ਲੱਗ ਜਾਂਦੇ ਆ ਉਹਨੂੰ ਪੱਤਝੜ ਵੀ ਕਹਿੰਦੇ ਆ ਪੱਤਝੜ ਵੀ ਕਹਿੰਦੇ ਹਾਂ ਅਤੇ ਸਰਦੀਆਂ ਦਾ ਮੌਸਮ ਬਹੁਤ ਵਧੀਆ ਹੁੰਦਾ ਹੈ ਸਰਦੀਆਂ ਦੇ ਵਿੱਚ ਆਪਾਂ ਜ਼ਿਆਦਾਤਰ ਕੱਪੜੇ ਪਾ ਸਕਦੇ ਹਾਂ ਅਤੇ ਆਪਣੀ ਪਰਸਨੈਲਿਟੀ 'ਤੇ ਜੱਚ ਜਿਹਾ ਤਾਂ ਕਰਕੇ ਮੈਨੂੰ ਸਰਦੀਆਂ ਦਾ ਤਿਉਹਾਰ ਵਧੀਆ ਲੱਗਦਾ ਹੈ